ਉਹ ਅਖ ਲਾਲ ਰੰਗ 'ਤੇ ਪੀਲਾ ਇੰਨਾ ਜੱਚਦਾ ਸੀਗਾ ਦੋਨੋਂ ਰੰਗ ਕਿ ਉਹ ਸਭ ਦੇ ਮਨ ਨੂੰ ਮੋਹ ਲੈਂਦਾ ਸੀਗਾ ਅਤੇ ਇਸ ਲਈ ਅਸੀਂ ਬਸ ਰੰਗ ਇੱਦਾਂ ਕਰਕੇ ਮੈਚ ਕਰ ਲਈਦੇ ਆ ਬਾਕੀ ਕਿਸੇ ਨੂੰ ਪੁੱਛ ਲਓ ਉਹਦੀ ਕਿਹੜੀ ਪਸੰਦ ਹੈ ਕਿਸੇ ਨੂੰ ਕਿੱਦਾਂ ਦਾ ਚਾਹੀਦਾ ਉਹਦੀ ਪਸੰਦ ਦਾ ਮੈਚ ਕਰਕੇ ਲਾ ਦਵੋ ਜਾਂ ਤੁਸੀਂ ਬੁੱਕਲੈਟ ਤੋਂ ਕੱਢ ਲਉ ਬੁੱਕਲੈਟ 'ਤੇ ਸਾਰੀ ਮੈਚਿੰਗ ਦੱਸੀ ਹੁੰਦੀ ਆ ਉੱਥੋਂ ਤੁਹਾਨੂੰ ਪਤਾ ਲੱਗ ਜਾਂਦਾ ਕਿ ਕਿਹੜਾ ਰੰਗ ਕਿਹਦੇ ਨਾਲ ਜੱਚਦਾ ਕਿਹੜਾ ਨਹੀਂ ਜੱਚਦਾ ਅਤੇ ਬਾਕੀ ਜਦੋਂ ਆਪਾਂ ਸਿਲਾਈ ਕਰਦੇ ਹਾਂ ਤਾਂ ਇਹ ਗੂੜੇ ਰੰਗਾਂ 'ਤੇ ਅਪ ਆਪਸ 'ਚ ਇੱਕ ਦੂਜੇ 'ਤੇ ਜੱਚ ਹੀ ਜਾਂਦੇ ਆ ਵਧੀਆ ਹੀ ਲੱਗਦੇ ਆ ਸਾ